ਇੱਕ ਸ਼ਾਨਦਾਰ ਗੇਮ ਜਿਹੜੀ ਕਿ ਮੈਂ ਆਪਣੇ ਕੰਪਿਊਟਰ 'ਤੇ ਖੇਡਦਾਂ ਹਾਂ ਉਹਦਾ ਨਾਂ ਹੈਗਾ ਜੀ ਟੀ ਏ ਫਾਈਵ ਗਰੈਂਡ ਥੈਂਪਟ ਓਟੋ ਫਾਈਵ ਇਹ ਉਸ ਟਾਇਮ ਲੌਂਚ ਹੋਈ ਸੀ ਜਦੋਂ ਮੈਂ ਆਪਣੀ ਛੇਵੀਂ ਕਲਾਸ ਵਿੱਚ ਹੁੰਦਾ ਸੀਗਾ ਅਤੇ ਇਸ ਗੇਮ ਨੂੰ ਮੈਂ ਉਸ ਉਦੋਂ ਤੋਂ ਹੀ ਖੇਡਦਾ ਆ ਰਿਹਾਂ ਹਾਂ ਇਸ ਇਹ ਇਹ ਗੇਮ ਬਹੁ ਬਹੁਤ ਵਧੀਆ ਗੇਮ ਹੈਗੀ ਹੈ ਇਹਦੇ ਵਿੱਚ ਇੱਕ ਮੈਪ ਹੁੰਦਾ ਹੈ ਇੱਕ ਇਨਸਾਨ ਹੁੰਦਾ ਹੈ ਜਿਹਦਾ ਕਿ ਕੰਟਰੋਲ ਸਾਡੇ ਹੱਥ ਵਿੱਚ ਹੁੰਦਾ ਹੈ ਅ ਅਤੇ ਅਸੀਂ ਇੱਕ ਮਿਸ਼ਨ ਕਰਨੇ ਹੁੰਦੇ ਹਨ ਜਿਹਦੇ ਨਾਲ ਸਾਨੂੰ ਪੈਸਾ ਜਿਹਦੇ ਨਾਲ ਸਾਨੂੰ ਸ਼ੋਹਰਤ ਵੀ ਮਿਲਦੀ ਹੈ ਉਸ ਗੇਮ ਦੇ ਵਿੱਚ ਅਤੇ ਇਹਨਾਂ ਚੀਜ਼ਾਂ ਦੇ ਨਾਲ ਅਸੀਂ ਵੱਡੀਆਂ ਵੱਡੀਆਂ ਗੱਡੀਆਂ ਟਰੱਕ ਟਰਾਲੇ ਪਰੌਪਰਟੀਆਂ ਵੀ ਖਰੀਦ ਸਕਦੇ ਹਾਂ ਗੇਮ ਦੇ ਵਿਚਕਾਰ ਹੀ ਅਤੇ ਇਹਨੂੰ ਖੇਡ ਕੇ ਇੱਕ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਅਸੀਂ ਇੱਕ ਜਿਹੜੀ ਅਸਲੀ ਦੁਨੀਆ ਹੈ ਉਹਨੂੰ ਹੀ ਅਸੀਂ ਕੰਪਿਊਟਰ ਦੇ ਵਿੱਚ ਕੈਦ ਕਰ ਲਿਆ ਹੈ ਅਸੀਂ ਅਤੇ ਉਹਦੇ ਨਾਲ ਅਸੀਂ ਜਿਹੜੀ ਸਾਡੀ ਮਨਮਰਜ਼ੀਆਂ ਨੇ ਇਸ ਗੇਮ ਨੂੰ ਖੇਡ ਕੇ ਅਸੀਂ ਪੂਰੀ ਕਰ ਸਕਦੇ ਹਾਂ ਅਸੀਂ ਕੋਈ ਵੀ ਕਾਰ ਚਲਾ ਸਕਦੇ ਹਾਂ ਕੋਈ ਵੀ ਟਰੱਕ ਚਲਾ ਸਕਦੇ ਹਾਂ ਕੁਛ ਵੀ ਕਰ ਸਕਦੇ ਹਾਂ ਬਹੁਤ ਹੀ ਆਨੰਦ ਆਉਂਦਾ ਹੈ